ਸਿੱਖ ਧਰਮ ਦੇ ਬਹੁਤ ਸਾਰੇ ਹਰ ਥਾਂ 'ਤੇ ਧਰਮ ਅਸਥਾਨ ਨੇ ਜਿਹੜੇ ਉਹ ਬਣੇ ਹੋਏ ਨੇ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਸ ਦਾ ਗੁਰੂ ਹੋਏ ਨੇ ਜਿਹੜੇ ਸਾਡੇ ਉਹ ਹਰ ਜਗ੍ਹਾ 'ਤੇ ਗਏ ਨੇ ਜਿਵੇਂ ਕਿ ਗੁਰ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਜਿਹੜਾ ਸਾਡਾ ਅਤੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਨੰਦੇੜ ਸਾਹਿਬ ਹਜ਼ੂਰ ਸਾਹਿਬ ਹੈ ਗੁਰਦੁਆਰਾ ਸ਼੍ਰੀ ਆਪਣਾ ਫਤਿਹਗੜ੍ਹ ਸਾਹਿਬ ਹੈ ਜਿੱਥੇ ਚਾਰ ਸ਼ ਦੋ ਸੈਬ ਛੋਟੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਬਹੁਤ ਸਾਰੇ ਹੋਰ ਥਾਵਾਂ 'ਤੇ ਵੀ ਨੇ ਨਨਕਾਣਾ ਸਾਹਿਬ ਆ ਜਿਵੇਂ ਕਿ ਉਹ ਪਾਕਿਸਤਾਨ ਦੇ ਵਿੱਚ ਪੈ ਜਾਂਦਾ ਬਹੁਤ ਸਾਰੇ ਗੁਰੂ ਗੁਰੂਆਂ ਦੇ ਨਾਲ਼ ਸਥਾਨ ਨੇ ਜਿਹੜੇ ਉਹ ਬਣੇ ਹੋਏ ਨੇ ਉਸ ਤੋਂ ਬਾਅਦ ਇਹ ਕਿ ਜਿਵੇਂ ਕਿ ਸਾਡਾ ਪਟਿਆਲੇ ਦੇ ਵਿੱਚ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਬਣਿਆ ਹੋਇਆ ਇੱਥੇ ਹਰ ਮਹੀਨੇ ਦੀ ਜਿਹੜੀ ਪੰਚਮੀ ਹੈ ਬਹੁਤ ਹੀ ਉੱਚ ਪੱਧਰ 'ਤੇ ਮਨਾਈ ਜਾਂਦੀ ਹੈ ਅਲੱਗ ਅਲੱਗ ਥਾਵਾਂ ਤੋਂ ਅਲੱਗ ਅਲੱਗ ਪਿੰਡਾਂ ਤੋਂ ਲੋਕ ਇਕੱਠੇ ਹੋ ਕੇ ਆਉਂਦੇ ਨੇ ਕਈ ਵਾਰ ਲੋਕ ਜਿੱਦਾਂ ਆਪਣੇ ਪਿੰਡ 'ਚੋਂ ਇੱਕ ਬੱਸ ਜਾਂ ਕਾਰ ਰਾਹੀਂ ਇਕੱਠੇ ਹੋ ਕੇ ਸੰਗਤ ਆਉਂਦੀ ਹੈ ਬਹੁਤ ਸਾਰਾ ਰਾਸ਼ਨ ਹੈ ਜਿਹੜੀ ਉਹ ਸੰਗਤ ਆਪਣੇ ਨਾਲ਼ ਆਪਣੇ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਲੈ ਕੇ ਆਉਂਦੀ ਹੈ ਬਹੁਤ ਭੀੜ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਕੋਈ ਹੈ ਜਿਹੜਾ ਉਹ ਪੰਚਮੀ ਵਾਲੇ ਦਿਨ ਇਸ਼ਨਾਨ ਕਰਨ ਨੂੰ ਬਹੁਤ ਹੀ ਚੰਗਾ ਮੰਨਦਾ ਕਿ ਇਹਦਾ ਇਹ ਸੀਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀਗਾ ਕਿ ਜੋ ਵੀ ਦੁੱਖ ਨਿਵਾਰਨ ਸਾਹਿਬ ਵਿਖੇ ਪੰਚਮੀ ਆਉਂਦਾ ਹੈ ਅਤੇ ਇਸ਼ਨਾਨ ਕਰਦਾ ਹੈ ਉਸ ਦੇ ਦੁੱਖਾਂ ਦਾ ਜਿਹੜਾ ਨਿਵਾਰਨ ਹੋ ਜਾਂਦਾ ਕਿ ਉਹਦੇ ਦੁੱਖ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਦੁੱਖ ਬਹੁਤ ਸਾਰੇ ਲੋਕਾਂ ਦੇ ਨੇ ਜਿਹੜੇ ਉਹ ਆਪਣੀ ਸ਼ਰਧਾ ਦੇ ਨਾਲ਼ ਦੂਰ ਹੁੰਦੇ ਨੇ ਹੋਰ ਦਿਨ ਵੀ ਜਿੱਦਾਂ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਮਨਾਏ ਜਾਂਦੇ ਨੇ ਨਗਰ ਕੀਰਤਨ ਕੱਢੇ ਜਾਂਦੇ ਨੇ ਜਦੋਂ ਕਿਸੇ ਗੁਰੂ ਦਾ ਗੁਰਪੁਰਬ ਦਿਨ ਹੁੰਦਾ ਜਾਂ ਸ਼ਹੀਦੀ ਦਿਵਸ ਹੁੰਦਾ ਉਹ ਮਨਾਇਆ ਜਾਂਦਾ ਉੱਚ ਪੱਧਰ ਦੇ ਬਾਹਰੋਂ ਕੀਰਤਨੀਏ ਢਾਡੀ ਬੁਲਾਏ ਜਾਂਦੇ ਨੇ ਦੀਵਾਨ ਸੱਜਦੇ ਨੇ ਪਾਠ ਹੁੰਦੇ ਨੇ ਜਿੱਦਾਂ ਸੁਖਮਨੀ ਸਾਹਿਬ ਦੇ ਪਾਠ ਚੱਲਦੇ ਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਕੋਈ ਸਾਡਾ ਸ਼ਹੀਦੀ ਦਿਹਾੜਾ ਅਸੀਂ ਮਨਾਉਂਦੇ ਹਾਂ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਦੋਂ ਅਸੀਂ ਇੱਥੇ ਮਨਾਉਂਦੇ ਹਾਂ ਤਾਂ ਸਾਡੇ ਗੁਰਦੁਆਰਾ ਸਾਹਿਬ ਚਾਲ੍ਹੀ ਦਿਨ ਨੇ ਜਿਹੜੇ ਪਾਠ ਉਹ ਲਗਾਤਾਰ ਚੱਲਦੇ ਰਹਿੰਦੇ ਨੇ ਤਾਂ ਉਹ ਉਹਨਾਂ ਪਾ ਉਸ ਪਾਠ ਦੇ ਦੌਰਾਨ ਵੀ ਜਿਹੜੀ ਸੰਗਤ ਹੈ ਬਹੁਤ ਸਾਰੀ ਮਤਲਬ ਇਕੱਠੀ ਹੋ ਕੇ ਗੁਰਬਾਣੀ ਦਾ ਜਾਪ ਕਰਦੀ ਹੈ ਅਤੇ ਸਿੱਖ ਧਰਮ ਇੱਕ ਬਹੁਤ ਹੀ ਵਧੀਆ ਧਰਮ ਹੈ ਅਤੇ ਬਹੁਤ ਹੀ ਸਿੱਖ ਮਰਿਆਦਾ ਜਿਹੜੀ ਬਹੁਤ ਹੀ ਚੰਗਾ ਹੈ ਅਤੇ ਹਰ ਕਿਸੇ ਨੂੰ ਕਹਿੰਦੇ ਕਿ ਸਿੱਖ ਧਰਮ ਨਾਲ਼ ਜੁੜੇ ਆਪਣਾ ਜਿਹੜਾ ਜ਼ਿੰਦਗੀ ਹੈ ਉਹਨੂੰ ਚੰਗੇ ਰਸਤੇ ਪਾਈਏ ਅਤੇ ਗੁਰੂਆਂ ਦੇ ਲੜ ਲਾਈਏ ਤਾਂ ਕਿ ਆਪਾਂ ਅਸੀਂ ਆਪਣੀ ਜ਼ਿੰਦਗੀ ਨੂੰ ਆ ਜਿਹੜਾ ਸਫ਼ਲ ਕਰ ਸਕੀਏ